ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਗੁਰਪ੍ਰੀਤ ਬੋਲਦਾ ਹਾਂ ਅਤੇ ਮੈਂ ਇੱਥੇ ਖਰੜ ਸ਼ਹਿਰ ਵਿੱਚ ਨਵਾਂ ਰਹਿਣ ਲੱਗਿਆ ਅਤੇ ਮੈਂ ਜਰਮਨ ਸ਼ੈਫਅਡ ਕੁੱਤਾ ਰੱਖਿਆ ਹੋਇਆ ੳਤੇ ਉਹ ਦੇ ਉਹ ਦਾ ਸਮਾਨ ਵਗੈਰਾ ਪੁੱਛਣਾ ਸੀ ਵੀ ਇੱਥੇ ਨੇੜੇ ਤੇੜੇ ਕੋਈ ਸ਼ੋਪ ਹੋਵੇ ਵਧੀਆ ਜੀ ਜਿੱਥੇੋਂ ਵਧਿਆ ਸਮਾਨ ਮਿੱਲ ਜੇ ਇਹਦਾ ਖਾਣੇ ਪੀਣੇ ਦਾ ਹਾਂਜੀ ਠੀਕ ਠੀਕ ਹੈ ਠੀਕ ਹੈ ਜੀ ਸੰਡੇ ਨੂੰ ਵੀ ਖੁੱਲਾ ਹੋ ਓਪਨ ਹੁੰਦਾ ਕਿ ਨਹੀਂ ਚਲੋ ਠੀਕ ਹੈ ਠੀਕ ਹੈ ਠੀਕ ਹੈ ਚਲੋ ਠੀਕ ਹੈ ਓਕੇ